ਮੈਂ ਪੰਜਾਬ ਦੇ ਵਿੱਚ ਰਹਿੰਦੀ ਹਾਂ ਅਤੇ ਪੰਜਾਬ ਦੇ ਵਿੱਚ ਜ਼ਿਆਦਾਤਰ ਪੰਜਾਬੀ ਪਟਿਆਲਾ ਸ਼ਾਹੀ ਸੂਟ ਪਟਿਆਲਾ ਸ਼ਾਹੀ ਸਲਵਾਰਾਂ ਵਾਲੇ ਸੂਟ ਪਾਏ ਜਾਂਦੇ ਹਨ ਇਸ ਤੋਂ ਇਲਾਵਾ ਪਜਾਮੀਆਂ ਅਤੇ ਪਲਾਜ਼ੋ ਵਾਲੇ ਸੂਟ ਵੀ ਪਾਏ ਜਾਂਦੇ ਹਨ ਪਰ ਜ਼ਿਆਦਾਤਰ ਪੰਜ ਪੰਜਾ ਪਟਿਆਲਾ ਸ਼ਾਹੀ ਸਲਵਾਰਾਂ ਵਾਲੇ ਸੂਟ ਅਤੇ ਪੰਜਾਬੀ ਘੱਗਰੇ ਜੋ ਹੈ ਉਹ ਉਹ ਉਹਨਾਂ ਨੂੰ ਜਾ ਉਨ੍ਹਾਂ ਦਾ ਜ਼ਿਆਦਾ ਪਹਿਨਿਆ ਜਾਂਦਾ ਹੈ ਅਤੇ ਇਹ ਜੋ ਪੰਜਾਬੀ ਘੱਗਰਿਆਂ ਵਾਲੇ ਸੂਟ ਹਨ ਉਹ ਜ਼ਿਆਦਾਤਰ ਗਿੱਧੇ ਵਾਲੀਆਂ ਮੁਟਿਆਰਾਂ ਯੂਸ ਕਰਦੀਆਂ ਹਨ ਇਸ ਤੋਂ ਇਲਾਵਾ ਰਵਾਇਤੀ ਕੱਪੜੇ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਅਸੀਂ ਫੁਲਕਾਰੀਆਂ ਫੁਲਕਾਰੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ 'ਤੇ ਬਾਗ਼ ਅਤੇ ਚੋਪ ਦੀ ਕਢਾਈ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਪੇਂਟ ਵਾਲੇ ਸੂਟ ਵੀ ਬਣਾਏ ਜਾਂਦੇ ਹਨ ਇਸ ਤੋਂ ਇਲਾਵਾ ਪਟਿਆਲਾ ਸ਼ਾਹੀ ਸਲਵਾਰਾਂ ਵਾਲੇ ਸੂਟ ਅਤੇ ਘੱਗਰ ਅਤੇ ਘੱਗਰੇ ਜੋ ਹੈ ਉਹ ਵੀ ਬਣਾਏ ਜਾਂਦੇ ਹਨ ਧਾਗੇ ਦੀ ਕਢਾਈ ਵਾਲੇ ਸੂਟ ਵੀ ਇਸ ਤੋਂ ਇਲਾਵਾ ਅਸੀਂ ਬਣਾਉਣੇ ਸ਼ੂਰੁ ਕੀਤੇ ਹਨ